ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਚਰਨਜੀਤ ਬੋਲਦੀ ਆ ਮੈਂ ਵਧੀਆ ਤੁਸੀਂ ਦੱਸੋ ਦੀ ਕਿਵੇਂ ਠੀਕ ਹੋ ਹੋਰ ਆਪਣੇ ਵਧੀਆ ਹੋਰ ਆਪਣੇ ਬੱਚਿਆਂ ਦਾ ਕੀ ਹਾਲ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਵੀ ਤੁਹਾਨੂੰ ਉਸੇ ਲਈ ਕਾਲ ਕਰੀ ਆ ਤੇ ਮੈਂ ਕਿਹਾ ਤੁਹਾਨੂੰ ਮੈਂ ਦੱਸ ਦੇਵਾਂ ਵੀ ਜਿਹੜਾ ਟੋਆ ਏ ਹਨਾ ਬਹੁਤ ਜਿਆਦੇ ਹੋਇਆ ਪਿਆ ਇਹ ਤੇ ਹੁਣ ਆਪਾਂ ਇਹਦਾ ਕੀ ਕਰੀਏ ਹਾਂਜੀ ਹਾਂਜੀ ਹਾਂਜੀ ਦੀ ਹਾਂਜੀ ਦੀ ਹਾ ਹਾਂਜੀ ਨਹੀਂ ਦੀ ਮੈਂ ਪਹਿਲਾਂ ਆਈ ਸੀ ਵੀ ਆਪਾਂ ਦੇਖ ਹੁਣ ਪਹਿਲਾਂ ਆਪਾਂ ਉਥੇ ਕਰੀ ਆ ਨਾ ਗੱਲ ਕਮੇਟੀ ਚ ਕਰੀ ਗੱਲ ਐਮ ਸੀ ਨੂੰ ਵੀ ਕਿਹਾ ਹੈ ਉਹਨਾਂ ਨੇ ਦੇਖ ਆਪਣੀ ਸਾਰਿਆਂ ਨੇ ਕਿਸੇ ਨੇ ਨਹੀਂ ਸੁਣੀ ਹਨਾ ਤੇ ਵੀ ਚਲੋ ਹੁਣ ਆਪਾਂ ਐ ਕਰਦੇ ਆ ਆਪਾਂ ਸਾਰੀ ਗਲੀ ਨੂੰ ਇਕੱਠਾ ਕਰਕੇ ਹਨਾ ਤੇ ਉਹਨਾਂ ਨੂੰ ਪੁੱਛਦੇ ਆ ਵੀ ਜੇ ਸਾਰਿਆਂ ਦੀ ਰਾਇ ਲੈਦੇ ਆ ਵੀ ਕੀ ਕਹਿੰਦੇ ਆ ਨਹੀਂ ਆਪਾਂ ਨੂੰ ਨਹੀਂ ਔਖਾ ਹੁਣ ਕਾਹਦਾ ਬੱਚੇ ਵੀ ਸਕੂਲ ਜਾਣਾ ਦੇਖੋ ਉਹਨਾਂ ਨੂੰ ਵੀ ਕਿੰਨਾ ਔਖਾ ਲੱਗਦਾ ਹਨਾ ਤੇ ਮਮੀ ਕੱਲ ਹੁਣ ਗੁਰਦੁਆਰੇ ਗਏ ਤੇ ਉਹ ਤਿਲਕ ਜਾਣੇ ਸੀਗੇ ਹਨਾ ਤੇ ਦੇਖ ਹੁਣ ਆਥਣੇ ਹਾਂਜੀ ਹਾਂਜੀ ਦੀ ਆਪਾਂ ਪੁੱਛਦੇ ਆ ਉਹਨਾਂ ਨੂੰ ਹਾਂਜੀ ਹਾਂ ਹਾਂਜੀ ਹਾਂਜੀ ਦੀ ਉਹ ਪਤਾ ਕੀ ਆ ਤੁਸੀਂ ਐ ਕਰਿਓ ਵੀ ਉਧਰ ਉਧਰਲੇ ਦੋ ਘਰਾਂ ਨੂੰ ਤੁਸੀਂ ਪੁੱਛ ਲਿਓ ਹਨਾ ਤੇ ਇਹਨਾਂ ਨੂੰ ਮੈਂ ਪੁੱਛ ਆਪਣੇ ਜਿਹੜੇ ਇਧਰ ਨਾਲ ਵਾਲੇ ਘਰ ਨੇ ਦੋਨੇ ਤੇ ਇਹਨਾਂ ਨੂੰ ਮੈਂ ਪੁੱਛ ਲੈਦੀ ਆ ਹਨਾ ਤੇ ਤੁਸੀਂ ਉਧਰ ਪਤਾ ਕਰ ਲਿਓ ਤੇ ਹੁਣ ਦੇਖ ਲਓ ਜਿਹੜਾ ਹਨਾ ਜਾਂ ਤਾਂ ਆਪਾਂ ਮਿੱਟੀ ਸਟਾ ਲਾਂਗੇ ਇਹਦੇ ਵਿੱਚ ਤੇ ਜਾਂ ਹੁਣ ਪੱਕਾ ਹੀ ਵੀ ਜਿਹੜੀਆਂ ਟਾਈਲਾਂ ਨਹੀਂ ਹੈਗੀਆਂ ਟੈਲਾਂ ਪੁੱਛ ਲਾਂਗੇ ਵੀ ਆਪਾਂ ਜੇ ਹਾਂਜੀ ਹਾਂਜੀ ਹਾਂਜੀ ਤੇ ਉਹ ਤੁਸੀਂ ਗੱਲ ਕਰ ਲਿਓ ਨਾਲ ਤਾ ਵੀਰ ਜੀ ਨੂੰ ਪੁੱਛ ਲਿਓ ਹਨਾ ਘਰੇ ਤੇ ਉਹ ਤੁਸੀਂ ਪਤਾ ਕਰਕੇ ਨਾ ਹਨਾ ਤੇ ਬਾਕੀ ਮੈਨੂੰ ਦੱਸ ਦਿਓ ਹਨਾ ਤੇ ਹੁਣ ਇਸ ਤੋਂ ਇਹ ਕਰਕੇ ਹਾਂ ਹਾਂ ਟੋਏ ਕਰਕੇ ਤਾਂ ਦੀਦੀ ਬਹੁਤ ਮੁਸ਼ਕਲ ਬਹੁਤ ਜਿਆਦੀ ਆਈ ਜਾਂਦੀ ਆ ਹਨਾ ਵੀ ਆਪਾਂ ਨੂੰ ਵੀ ਹੁਣ ਨਾ ਤਾਂ ਅਗਲਾ ਵੀ ਗਲੀ ਚ ਨਿਕਲਣ ਜੋਗਾ ਹਨਾ ਤੇ ਹੁਣ ਵਾਹਨ ਵੀ ਨਹੀਂ ਕੋਈ ਆਉਂਦਾ ਹੈਗਾ ਵਹੀਕਲ ਵਗੈਰਾ ਨੂੰ ਵੀ ਔਖਾ ਹੋਈ ਜਾਂਦਾ ਹਨਾ ਤੇ ਸਾਰਾ ਹਾਂ ਹਾਂਜੀ ਹਾਂਜੀ ਦੀ ਤੇ ਆਪਾਂ ਸਾਰੇ ਜਣੇ ਰਲ ਹਾਂਜੀ ਦੀ ਆਪਾਂ ਸਾਰੇ ਰਲ ਕੇ ਦੇਖਦੇ ਆਂ ਹਨਾ ਵੀ ਕੀ ਕਹਿੰਦੇ ਨੇ ਉਹ ਵੀ ਬਾਕੀ ਸਾਰੇ ਗਲੀ ਵਾਲਿਆਂ ਨੂੰ ਪਤਾ ਕਰਕੇ ਫੇਰ ਹੀ ਪਤਾ ਲੱਗੂਗਾ ਹਨਾ ਵੀ ਜੇ ਗਲੀ ਵਾਲੇ ਸਾਰੇ ਮੰਨਣਗੇ ਤਾਂ ਫਿਰ ਹੀ ਨਹੀਂ ਚਲੋ ਫਿਰ ਆਪਾਂ ਐ ਕਰਾਂਗੇ ਵੀ ਆਪਾਂ ਦੋਨੇ ਘਰ ਕਰਵਾ ਲਾਂਗੇ ਹਨਾ ਵੀ ਜੇ ਹਾਂਜੀ ਹਾਂਜੀ ਹਾਂਜੀ ਜੇ ਉਹ ਸਾਰੇ ਮੰਨਦੇ ਆ ਤਾਂ ਠੀਕ ਆ ਵੀ ਮੰਨ ਲਓ ਜੇ ਉਹ ਨਹੀਂ ਮੰਨਦੇ ਹਨਾ ਤੇ ਚਲੋ ਫਿਰ ਆਪਾਂ ਕਰ ਲਾਂਗੇ ਹਾਂ ਤੇ ਹਾਂ ਹਾਂਜੀ ਚਲੋ ਠੀਕ ਆ ਦੀਦੀ ਫਿਰ ਹਾਂ ਆਪਾਂ ਕੱਲ ਤੋਂ ਪੁੱਛ ਲਾਂਗੇ ਹਨਾ ਹਾਂ ਹਾਂ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ